ਹੈਲੋ ਬਾਈ ਜੀ ਮੇਰਾ ਨਾਮ ਜੁਗਰਾਜ ਸਿੰਘ ਹੈ ਮੈਂ ਸਾਢੇ ਗਿਆਰ੍ਹਾਂ ਵਜੇ ਜਮੈਟੋ ਤੋਂ ਔਡਰ ਕੀਤਾ ਸੀ ਸ਼ੈਫ ਸਪੈਸ਼ਲ ਰੈਸਟੋਰੈਂਟ ਤੋਂ ਦੋ ਪੀਜੇ ਔਡਰ ਕੀਤੇ ਸੀ ਇਹ ਦੋ ਸੌ ਚਾਲ਼ੀ ਰੁਪਏ ਦਾ ਟੋਟਲ ਸੀਗਾ ਅਤੇ ਪੇਮੈਂਟ ਮੈਂ ਔਨਲਾਈਨ ਪਹਿਲਾਂ ਹੀ ਕਰ ਦਿੱਤੀ ਹੈ ਗੂਗਲ ਪੇ ਰਾਹੀਂ ਅਤੇ ਮੈਂ ਇਹ ਪੁੱਛਣਾ ਸੀਗਾ ਕਿ ਕਿਤਨ ਕਿੰਨਾ ਟਾਈਮ ਲੱਗ ਸਕਦਾ ਮੈਂ ਤੁਹਾਨੂੰ ਮਤਲਬ ਜਲਦੀ ਤੋਂ ਜਲਦੀ ਆ ਸਕਦੇ ਤਾਂ ਦੱਸ ਦਿਓ ਕਿਉਂਕਿ ਜ਼ਰੂਰੀ ਹੈ ਸਾਡੇ ਰਿਸ਼ਤੇਦਾਰ ਆਏ ਹੋਏ ਸੀ ਉਹਨਾਂ ਨੇ ਜਲਦੀ ਜਾਣਾ ਸੀ ਇਸ ਕਰਕੇ ਇਹ ਪੁੱਛਣਾ ਸੀਗਾ ਕਿ ਜੇ ਤੁਸੀਂ ਜਲਦੀ ਤੋਂ ਜਲਦੀ ਆ ਸਕੋ ਤਾਂ ਵਧੀਆ ਹੋਊਂਗਾ ਐਡਰੈਸ ਤੁਹਾਨੂੰ ਮੈਂ ਚੰਗੀ ਤਰ੍ਹਾਂ ਦੱਸ ਦਿੰਨਾ ਤੁਸੀਂ ਰੈਲਮਾਜਰੇ ਦਾ ਔਡਰ ਹੈ ਰੈਲਮਾਜਰੇ ਆ ਕੇ ਤੁਸੀਂ ਨਹਿਰ ਪਾਰ ਆ ਜਿਓ ਨਹਿਰ ਪਾਰ ਸਾਹਮਣੇ ਇੱਕ ਸਬਜ਼ੀ ਦੀ ਦੁਕਾਨ ਆਵੇਗੀ ਸਬਜ਼ੀ ਦੀ ਦੁਕਾਨ ਵਾਲੇ ਤੋਂ ਪੁੱਛ ਲਿਓ ਮੇਰਾ ਨਾਮ ਲੈ ਦਿਓ ਉਹ ਤੁਹਾਨੂੰ ਦੱਸ ਦੂੰਗਾ ਪਰ ਜੇ ਨਾ ਪਤਾ ਲੱਗਿਆ ਤੁਸੀਂ ਉਹਤ ਸਿੱਧਾ ਆ ਜਿਓ ਅਤੇ ਉਸ ਤੋਂ ਬਾਅਦ ਮੈਨੂੰ ਕੋਲ ਕਰ ਲਿਓ ਵੈਸੇ ਥੋੜ੍ਹਾ ਉਹਦਾ ਰੋਡ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਉਹਦਾ ਅਤੇ ਉਹ 'ਚ ਥੋੜ੍ਹੀ ਸਾਨੂੰ ਡਿਫੀਕਲਟੀ ਆ ਰਹੀ ਹੈ ਪਰ ਪਲੀਜ਼ ਜਲਦੀ ਕਰਿਓ ਜੇ ਹੋ ਸਕੇ ਜਿੰਨਾ ਜਲਦੀ ਆ ਜਿਓ ਅਤੇ ਪੇਮੈਂਟ ਮੈਂ ਪਹਿਲਾਂ ਹੀ ਕਰਤੀ ਆ